ਹਰੇਕ ਕਿਸੇ ਵਿਅਕਤੀ ਦਾ ਆਪਣਾ ਆਪਣਾ ਅਲੱਗ ਅਲੱਗ ਧਰਮ ਹੁੰਦਾ ਹੈ ਜਿਵੇਂ ਕਿ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਅਤੇ ਮੈਂ ਜ਼ਿਆਦਾਤਰ ਆਪਣਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਵਿੱਚ ਕਰਦੀ ਹਾਂ ਪਰ ਮੈਂ ਇਸ ਦੇ ਨਾਲ਼ ਨਾਲ਼ ਹੋਰ ਸਾਰੇ ਧਰਮਾਂ ਦੀ ਵੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹਾਂ ਉਹਨੂੰ ਬਹੁਤ ਹੀ ਮਾਣ ਦਿੰਦੀ ਹਾਂ ਪਰ ਸਿੱਖ ਫੈਮਲੀ 'ਚ ਹੋਣ ਕਰਕੇ ਮੈਂ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹਾਂ ਅਤੇ ਇਹਨਾਂ ਵਿੱਚ ਕਈ ਗੁਰੂ ਗ੍ਰੰਥ ਸਾਹਿਬ ਵਿੱਚ ਕਾਫ਼ੀ ਸਾਰੀਆਂ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਜਿਵੇਂ ਕਿ ਭੁੱਖੇ ਨੂੰ ਖਾਣਾ ਖਵਾਉਣਾ ਸਾਡੇ ਜਿਹੜੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਹੋਏ ਹਨ ਉਹਨਾਂ ਨੇ ਸੱਚਾ ਸੌਦਾ ਕੀਤਾ ਸੀਗਾ ਅਤੇ ਉਹਨਾਂ ਵਿੱਚ ਉਹਨਾਂ ਨੇ ਭੁੱਖੇ ਜਿਹੜੇ ਸਾਧੂਆਂ ਨੂੰ ਫ਼ਕੀਰਾਂ ਨੂੰ ਖਾਣਾ ਖਵਾਇਆ ਸੀ ਵੀਹ ਰੁਪਏ ਨਾਲ਼ ਅਤੇ ਇਹ ਇਹਨਾਂ ਦੀ ਸਿੱਖਿਆਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ ਗਈਆਂ ਨੇ ਕਿ ਹਮੇਸ਼ਾ ਜੇ ਜੇ ਕੋਈ ਆਪਾਂ ਨੂੰ ਕੋਈ ਭੁੱਖਾ ਦਿਖੇ ਉਹਨੂੰ ਖਾਣਾ ਖਿਲਾਉਣਾ ਹੁਣ ਕਈ ਸਾਰੇ ਗੁਰਦੁਆਰਿਆਂ ਵਿੱਚ ਲੰਗਰ ਹੁੰਦਾ ਹੈ ਅਤੇ ਉਹ ਭੁੱਖੇ ਲੋਕਾਂ ਨੂੰ ਖਾਣਾ ਖਵਾਉਂਦੇ ਨੇ ਜਿਹੜੇ ਨਹੀਂ ਖਾਣਾ ਜਿਹੜੇ ਆਪਣਾ ਟਾਈਮ ਇੱਕ ਟਾਈਮ ਦੀ ਰੋਟੀ ਵੀ ਨਹੀਂ ਖਾ ਸਕਦੇ ਉਹਨਾਂ ਨੂੰ ਖਾਣਾ ਖਿਲਾਇਆ ਜਾਂਦਾ ਹੈ ਗੁਰਦੁਆਰਿਆਂ ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਵਿੱਚ ਇੱਕ ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਖਾਣਾ ਖਵਾਇਆ ਜਾਂਦਾ ਹੈ ਭੁੱਖੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਉਹਨਾਂ ਨੂੰ ਖਾਣਾ ਵਧੀਆ ਤਰੀਕੇ ਨਾਲ਼ ਖਵਾਇਆ ਜਾਂਦਾ ਹੈ ਲੰਗਰ ਵਿੱਚ ਬਿਠਾ ਕੇ ਅਤੇ ਹੋਰ ਵੀ ਜ਼ਿਆਦਾ ਸਿੱਖ ਧਰਮ ਵਿੱਚ ਸਾਰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਕਿਸੇ ਨੂੰ ਵੀ ਨੀਵੀਂ ਨੀਵਾਂ ਨਹੀਂ ਸਮਝਣਾ ਚਾਹੀਦਾ ਸਾਰੇ ਜਾਤੀਆਂ ਦੀ ਸ ਰਿਸਪੈਕਟ ਕਰਨੀ ਚਾਹੀਦੀ ਹੈ ਜੇ ਕੋਈ ਵਿਅਕਤੀ ਆਪਾਂ ਨੂੰ ਕੋਈ ਦਰਦ ਵਿੱਚ ਦਿਖਦਾ ਹੈ ਉਸਦੀ ਫਟਾਫਟ ਜਾ ਕੇ ਹੈਲਪ ਕਰਨੀ ਚਾਹੀਦੀ ਹੈ ਉਸਨੂੰ ਉਸਨੂੰ ਆਪਣੇ ਹੀ ਵਾਂਗ ਸਮਝਣਾ ਚਾਹੀਦਾ ਹੈ ਉਸਨੂੰ ਆਪਣੇ ਉਸ ਨੂੰ ਆਪਣੇ ਵਾਂਗ ਸਮਝਣਾ ਚਾਹੀਦਾ ਅਤੇ ਉਸਨੂੰ ਵਧੀਆ ਤਰੀਕੇ ਨਾਲ਼ ਟ੍ਰੀਟ ਕਰਨਾ ਚਾਹੀਦਾ ਹੈ ਉਸਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ ਅਤੇ ਆਪਣੇ ਆਪ ਵਿੱਚ ਜ਼ਿਆਦਾ ਅਹੰਕਾਰ ਨਹੀਂ ਰੱਖਣਾ ਚਾਹੀਦਾ ਦੂਜਿਆਂ ਨੂੰ ਕਾਇੰਡਨੈਸ ਦਿਖਾਉਣੀ ਚਾਹੀਦੀ ਹੈ